ਬੈਂਕਿੰਗ ਦਾ ਅੱਜ ਕੱਲ੍ਹ ਸਾਡੇ ਇਹ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਚੱਲ ਰਿਹਾ ਪੰਜਾਬ ਦੇ ਵਿੱਚ ਬੈਂਕਿੰਗ ਨੂੰ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਕਾਫੀ ਚਲੋ ਸਾਡਾ ਪੇਂਡੂ ਜੀਵਨ ਹੈ ਪਿੰਡਾਂ ਦਾ ਜੀਵਨ ਹੈ ਪਿੰਡਾਂ ਦੇ ਲੋਕ ਹੈ ਅਤੇ ਉਹਨਾਂ ਨੂੰ ਬੈਂਕਾਂ ਨਾਲ ਜੋੜਿਆ ਜਾ ਰਿਹਾ ਬੈਂਕਾਂ ਨਾਲ ਜੋੜ ਕੇ ਉਹਨਾਂ ਲੋਕਾਂ ਨੂੰ ਬੈਂਕਾਂ ਦੀ ਜਿਹੜੀਆਂ ਜੋ ਪੋਲਸੀਆਂ ਜਾਂ ਬੈਂਕਾਂ ਦੀਆਂ ਜਿਹੜੀਆਂ ਸੁਵਿਧਾਵਾਂ ਹੈ ਉਹਨਾਂ ਦੇ ਲਾਭ ਜਿਹੜੇ ਆ ਲੋਕਾਂ ਤੱਕ ਪਹੁੰਚਾਏ ਜਾ ਰਹੇ ਆ ਬੈਂਕਾਂ ਤੋਂ ਸਾਨੂੰ ਹੁਣ ਜਿਵੇਂ ਛੋਟੇ ਕਿਸਮ ਦੇ ਲੋਨ ਬੜੇ ਆਸਾਨੀ ਨਾਲ ਮਿਲ ਜਾਂਦੇ ਹੈ ਸਾਨੂੰ ਅਸੀਂ ਕੋਈ ਆਪਣਾ ਸਮਾਨ ਸਕੇਲ ਪੱਧਰ 'ਤੇ ਕੋਈ ਛੋਟੇ ਲੈਵਲ ਦੇ ਜਾਂ ਲਘੂ ਉਦਯੋਗ ਦੇ ਤੌਰ 'ਤੇ ਕੋਈ ਕੰਮ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਬੈਂਕਾਂ ਦਾ ਜਿਹੜਾ ਅਹਿਮ ਰੋਲ ਬਹੁਤ ਵਧੀਆ ਚੱਲ ਰਿਹਾ ਬੈਂਕਿੰਗ ਤੋਂ ਅਸੀਂ ਆਪਣੀ ਸਮੁਦਿਤ ਰਹੇ ਹਾਂ ਅਤੇ ਉਹਦੇ ਵਿੱਚ ਸਾਨੂੰ ਜਿਹੜਾ ਲੋਨ ਦੇ ਰੂਪ ਵਿੱਚ ਬੈਂਕ ਪੈਸਾ ਸਾਨੂੰ ਦੇ ਦਿੰਦਾ ਜੋ ਕਿ ਸੀਮਤ ਕਿਸ਼ਤਾਂ ਘੱਟ ਵਿਆਜ ਦੇ ਤੌਰ 'ਤੇ ਸਾਨੂੰ ਪੈਸਾ ਵਰਤਣ ਦੇ ਤੌਰ 'ਤੇ ਮਿਲ ਜਾਂਦਾ ਅਤੇ ਉਸ ਤੋਂ ਬਾਅਦ ਉਹ ਪੈਸੇ ਨੂੰ ਅਸੀਂ ਸਮੇਂ ਦੇ ਬਲ ਨਾਲ ਅਸੀਂ ਉਸ ਪੈਸੇ ਨੂੰ ਕਿਸ਼ਤਾਂ ਦੇ ਰੂਪ ਦੇ ਵਿੱਚ ਬੈਂਕਾਂ ਨੂੰ ਮੋੜਦੇ ਹਾਂ ਅਤੇ ਜਿਹਦੇ ਕਰਕੇ ਸਾਨੂੰ ਬੈਂਕਾਂ ਤੋਂ ਕਿਸੇ ਤਰ੍ਹਾਂ ਦੀ ਫਿਊਚਰ ਦੇ ਵਿੱਚ ਜੇ ਕੋਈ ਹੋਰ ਲੈਣ ਦੇਣ ਦੀ ਪੈਸੇ ਦੀ ਲੋੜ ਪੈਂਦੀ ਹੈ ਤਾਂ ਬੈਂਕ ਦਾ ਵਿਸ਼ਵਾਸ ਸਾਡੇ ਪ੍ਰਤੀ ਬਣਦਾ ਹੈ ਵਿਸ਼ਵਾਸ ਬਣਨਾ ਬਹੁਤ ਜ਼ਰੂਰੀ ਹੈ ਬੈਕਿੰਗ ਸੈਕਟਰ ਦੇ ਨਾਲ ਨਾਲ ਨਾਲ ਬੀਮੇ ਦੇ ਜੋ ਅੱਜ ਕੱਲ੍ਹ ਸਿਸਟਮ ਚੱਲ ਰਿਹਾ ਬਈ ਬੀਮੇ ਦੇ ਵਿੱਚ ਬੈਂਕਾਂ ਦੇ ਨਾਲ ਹੀ ਜਦੋਂ ਖਪਤਕਾਰ ਜਾਂ ਆਪਣੇ ਗਾਹਕ ਕੋਈ ਆਪਣਾ ਬੈਂਕ ਦੇ ਵਿੱਚ ਖਾਤਾ ਖੁਲਵਾਉਂਦਾ ਤਾਂ ਉਹਦੇ ਨਾਲ ਹੀ ਉਹਨੂੰ ਬੈਂਕ ਦੀ ਤਰਫੋਂ ਇਹੀ ਦੋ ਲੱਖ ਦਾ ਢਾਈ ਲੱਖ ਦਾ ਐਕਸੀਡੈਂਟਲ ਜੋ ਬੀਮਾ ਹੈ ਉਹ ਮਿਲ ਜਾਂਦਾ ਉਹਦੇ ਵਿੱਚ ਵੀ ਉਸ ਖਪਤਕਾਰ ਨੂੰ ਗਾਹਕ ਨੂੰ ਜੋ ਹੈ ਬੈਂਕਾਂ ਦੀ ਤਰਫੋਂ ਜੋ ਕੋਈ ਕਿਸੇ ਖਪਤਕਾਰ ਜਾਂ ਗਾਹਕ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਬੈਂਕਾਂ ਦਾ ਜਿਹੜਾ ਹੈ ਬੀਮਾ ਪੋਲਸੀ ਵਾਲਾ ਰੂਲ ਲਾਗੂ ਹੋ ਜਾਂਦਾ ਇਹਦੇ 'ਤੇ ਖਪਤ ਜਿਹੜਾ ਗਾਹਕ ਹੈ ਉਹਨੂੰ ਇਸ ਚੀਜ਼ ਦਾ ਲਾਭ ਮਿਲਦਾ ਇਸ ਲਾਭ ਦੇ ਚਲਦਿਆਂ ਹੀ ਅੱਜ ਕੱਲ੍ਹ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਕੱਲ੍ਹ ਸਕੂਲ ਲੈਵਲ ਦੇ ਵਿੱਚ ਜੋ ਬੱਚਿਆਂ ਦੇ ਵਜ਼ੀਫੇ ਵਗੈਰਾ ਹੈਗੇ ਆ ਉਹ ਵੀ ਬੈਂਕ ਕ ਖਾਤਿਆਂ ਦੇ ਵਿੱਚ ਹੀ ਸਿੱਧੇ ਪੈਸੇ ਦਿੱਤੇ ਜਾ ਰਹੇ ਆ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਵੀ ਧੋਖਾਧੜੀ ਲੋਕ ਧੋਖਾਧੜੀ ਤੋਂ ਜਿਹੜੇ ਕੋਈ ਬੱਚੇ ਆ ਜਾਂ ਬਜ਼ੁਰਗ ਹੈ ਜਾਂ ਆਪਣੇ ਯੂਥ ਹੈ ਜਾਂ ਅਨਪੜ੍ਹ ਸਾਡੇ ਜੇ ਮੰਨ ਲਓ ਅਨਪੜ੍ਹ ਜੇ ਬੱਚਾ ਕੋਈ ਜਾਂ ਉਹ ਬੰਦੇ ਹੈ ਉਹਨਾਂ ਕਿਸੇ ਤਰ੍ਹਾਂ ਦਾ ਧੋਖਾ ਧਾਂਦਲੀ ਨਾ ਹੋ ਸਕੇ ਇਸ ਕਰਕੇ ਬੈਂਕਿੰਗ ਦੇ ਨਾਲ ਰਿਲੇਟਡ ਇਹੀ ਗੱਲਾਂ ਪਲਸ ਇੱਕ ਅੱਜ ਕੱਲ੍ਹ ਚੀਜ਼ ਹੋਰ ਹੈ ਜੋ ਕੇ ਵਾਈ ਸੀ ਵਗੈਰਾ ਚੱਲ ਰਹੀ ਹੈ ਉਹ ਵੀ ਸੰਬੰਧਿਤ ਵ ਗਾਹਕ ਸੰਬੰਧਤ ਵਿਅਕਤੀ ਦੇ ਫੋਨ ਉੱਪਰ ਹੀ ਓ ਟੀ ਪੀ ਵਗੈਰਾ ਆ ਕੇ ਜੋ ਅਕਾਊਂਟ ਦੀ ਓਪਨਿੰਗ ਹੈ ਖਾਤੇ ਜਿਹਦਾ ਖੁੱਲ੍ਹਣਾ ਜਾਂ ਪੈਸਿਆਂ ਦੀ ਨਿਕਾਸੀ ਹੈ ਜਾਂ ਪੈਸਿਆਂ ਦਾ ਜਮਾਂ ਕਰਾਉਣਾ ਉਹਦਾ ਵੀ ਅੱਜ ਕੱਲ੍ਹ ਮੈਸੇਜ ਦੇ ਰੂਪ ਦੇ ਵਿੱਚ ਖਪਤਕਾਰ ਜਾਂ ਗਾਹਕ ਨੂੰ ਇੱਕ ਸੈਟਿਸਫੈਸ਼ਨ ਮਿਲਦੀ ਹੈ